ਸਾਡੇ ਖੇਤਰ ਵਿੱਚ ਦਸਵੀਂ ਜਮਾਤ ਤੋਂ ਬਾਅਦ ਵਿਦਿਆਰਥੀਆਂ ਦੀਆਂ ਵਿੱਦਿਅਕ ਤਰਜ ਤਰਜੀਹਾਂ ਬਹੁਤ ਹਨ ਵਿਦਿਆਰਥੀਆਂ ਨੂੰ ਇਹ ਹੈ ਕਿ ਅਸੀਂ ਅੱਗੇ ਪੜ੍ਹੀਏ ਅਤੇ ਆਪਣੇ ਜੀਵਨ ਨੂੰ ਸੁਖਾਲਾ ਬਣਾਈਏ ਪੜ੍ਹਾਈ ਦੇ ਇਹ ਪੜ੍ਹਾਈ ਦੇ ਨਾਲ ਨਾਲ ਹੀ ਜੀਵਨ ਦੇ ਸਾਰੇ ਆਨੰਦ ਮਾਣ ਸਕਦੇ ਹਾਂ ਪੜ੍ਹਾਈ ਇੱਕ ਪੜ੍ਹਾਈ ਜਾਂ ਵਿੱਦਿਆ ਵਿੱਦਿਆ ਇਕ ਅਜਿਹਾ ਸਾਧਨ ਹੈ ਜਿਸ ਨਾਲ ਅਸੀਂ ਆਪਣੇ ਆਪ ਨੂੰ ਸੈਲਫ ਇੰਡੀਪੈਡੈਂਟ ਬਣਾ ਸਕਦੇ ਹਾਂ ਇਸ ਕਰਕੇ ਸਾਡੇ ਸਾਡੇ ਖੇਤਰ ਦੇ ਸਾਡੇ ਖੇਤਰ ਦੇ ਵਿਦਿਆਰਥੀਆਂ ਦੀਆਂ ਵਿੱਦਿਅਕ ਤਰਜੀਹਾਂ ਤਰਜੀਹਾਂ ਇਹ ਹਨ ਕਿ ਉਹ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣ ਅਤੇ ਆਪਣੇ ਜੀਵਨ ਵਿੱਚ ਹਰ ਮੁਕਾਮ ਹਾਸਿਲ ਕਰ ਸਕਣ